ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਤੇ ਮੈਂ ਸੋਸ਼ਲ ਮੀਡੀਆ 'ਤੇ ਆਪਣੀ ਫੋਟੋਜ਼ ਅਤੇ ਵੀਡੀਓਜ ਪਾਉਂਦਾ ਹਾਂ ਜਦੋਂ ਕਿ ਮੈਂ ਕਿਤੇ ਘੁੰਮਣ ਜਾ ਰਿਹਾ ਹੋਵਾਂ ਜਾਂ ਕਿਤੇ ਘੁੰਮਣ ਗਿਆ ਹੋਵਾਂ ਅਤੇ ਉਹਨੂੰ ਆਪਣੇ ਫੈਮਲੀ ਮੈਂਬਰਸ ਦੋਸਤਾਂ ਨਾਲ ਸ਼ੇਅਰ ਕਰਦਾ ਹਾਂ ਕਿ ਮੈਂ ਅੱਜ ਇੱਥੇ ਘੁੰਮਣ ਗਿਆ ਸੀ ਜਾਂ ਮੈਂ ਇੱਦਾਂ ਘੁੰਮਣ ਗਿਆ ਸੀਗਾ ਅਤੇ ਫਿਰ ਉਹਦੇ ਬਾਅਦ ਟੈਕਨੋਲੋਜੀ ਦੇ ਸੰਪਰਕ ਸਾਡੀ ਬਹੁਤ ਮਦਦ ਕਰਦਾ ਆ ਜਿਵੇਂ ਕਿ ਅ ਮੇਰੀ ਮੇਰੇ ਪਾਪਾ ਦਿੱਲੀ ਰਹਿੰਦੇ ਹਨ ਅਤੇ ਉਹਨਾਂ ਨਾਲ ਮੈਂ ਵੀਡੀਓ ਕਾਲ ਕਰ ਕੇ ਅ ਉਹਨਾਂ ਨਾਲ ਗੱਲ ਕਰ ਸਕਦਾ ਹਾਂ ਆਪਣੇ ਆਪਣਾ ਆਪਣੀ ਫੀਲਿੰਗਸ ਜਾਂ ਆਪਣਾ ਆਪਣੀ ਕੋਈ ਗੱਲ ਉਹਨਾਂ ਨੂੰ ਦੱਸ ਸਕਦਾ ਹਾਂ ਅਤੇ ਜਿਹਦੇ ਕਰਕੇ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਫਿਰ ਉਹਦੇ ਬਾਅਦ ਆਪਣੀ ਜਿੱਦਾਂ ਸੰਪਰਕ ਹੋਰ ਸੰਪਰਕ ਕਿਵੇਂ ਕਿ ਜਿਵੇਂ ਕੋਈ ਆਪਾਂ ਇੰਸਟਾਗ੍ਰਾਮ ਯੂਜ ਕਰਕੇ ਕਿ ਕਿਸੇ ਹੋਰ ਸਟੇਟ ਦੇ ਬੰਦੇ ਨੂੰ ਮੈਸੇਜ ਵੀ ਕਰ ਸਕਦੇ ਹਾਂ ਜਿਹਦੇ ਕਰਕੇ ਕਿ ਸਾਨੂੰ ਉਹਦਾ ਕਲਚਰ ਰਿਲੀਜਨ ਅਤੇ ਉਹਦੇ ਬਾਰੇ ਪਤਾ ਲੱਗਦਾ ਹੈ ਕਿ ਉਹ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈ ਫਿਰ ਉਹਦੇ ਬਾਅਦ ਆਪਣਾ ਕਿ ਮੈਂ ਆਪਣੀ ਨਿਜਤਾ ਤੋਂ ਬਹੁਤ ਜ਼ਿਆਦਾ ਡਰਦਾ ਹਾਂ ਕਿਉਂਕਿ ਪ੍ਰਾਈਵੇਸੀ ਸਾਰਿਆਂ ਨੂੰ ਇੰਪੋਰਟੈਂਟ ਹੁੰਦੀ ਹੈ ਅਤੇ ਜਿਹਦੇ ਕਰਕੇ ਕਿ ਜੇ ਕਿਸੇ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਵਾਸਤੇ ਬਹੁਤ ਜ਼ਿਆਦੀਆਂ ਮਤਲਬ ਵਲਗਰ ਕੰਟੈਂਟ ਵੀ ਆਉਂਦਾ ਜਿਹਦੇ ਕਰਕੇ ਕਦੀ ਕਦਾਰ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਨਹੀਂ ਪੈਣੀਆਂ ਚਾਹੀਦੀਆਂ ਸੋਸ਼ਲ ਮੀਡੀਆ 'ਤੇ ਉਹ ਵੀ ਪੈ ਜਾਂਦੀਆਂ ਹਨ ਪਰਸਨਲ ਫੋਟੋਜ ਅਤੇ ਉਹ ਨਹੀਂ ਪੈਣੀਆਂ ਚਾਹੀਦੀਆਂ ਅਤੇ ਮੈਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਅਤੇ ਮੈਂ ਬਹੁਤ ਜ਼ਿਆਦਾ ਡਰਦਾ ਹਾਂ ਕਿ ਇੱਦਾਂ ਕੁਛ ਨਾ ਹੋ ਜਾਵੇ ਜਿਹਦੇ ਕਰਕੇ ਕਿ ਮੇਰੇ ਘਰਦਿਆਂ ਨੂੰ ਅਤੇ ਮੈਨੂੰ ਕੋਈ ਅੱਗੇ ਪ੍ਰੋਬਲਮ ਹੋਵੇ ਅਤੇ ਮੈਂ ਆਪਣੀ ਪ੍ਰਾਈਵੇਸੀ ਨੂੰ ਬਹੁਤ ਜ਼ਿਆਦਾ ਆਪਣੀ ਪ੍ਰਾਈਵੇਸੀ ਨੂੰ ਪਹਿਲੀ ਪ੍ਰੀਓਰਿਟੀ ਮੰਨਦਾ ਹਾਂ ਕਿ ਹਾਂ ਪ੍ਰਾਈਵੇਸੀ ਸਾਰਿਆਂ ਦੀ ਸਾਰਿਆਂ ਦੀ ਹੋਣੀ ਚਾਹੀਦੀ ਹੈ